ਜਿਹੜੀ ਵੀ ਸੈਲਾਨੀ ਕਿਸੇ ਹੋਰ ਦੇਸ਼ ਵਿੱਚ ਘੁੰਮਣ ਆਉਂਦੇ ਹਨ ਤਾਂ ਉਹਨਾਂ ਨੂੰ ਕਈ ਸਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਉਹਨਾਂ ਲਈ ਬਹੁਤ ਹੀ ਔਖਾ ਹੁੰਦਾ ਹੈ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ ਜਿਵੇਂ ਕਿ ਦਸਤਾਵੇਜ਼ ਨਿਵਾਸ ਖਾਣਾ ਆਵਾਜਾਈ ਇਹ ਮੁੱਖ ਚੁਣੌਤੀਆਂ ਹਨ ਇਹਨਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਜਦੋਂ ਉਹ ਕਿਸੇ ਦੇਸ਼ ਵਿੱਚ ਘੁੰਮਣ ਲਈ ਆਉਂਦੇ ਹਨ ਤਾਂ ਉਹਨਾਂ ਕੋਲ ਦਸਤਾਵੇਜ਼ ਨਹੀਂ ਹੁੰਦੇ ਹਨ ਜਿਹਨਾਂ ਕਾਰਨ ਉਹਨਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹਨਾਂ ਕਾਰਨ ਉਹ ਕੋਈ ਚੀਜ਼ ਖਰੀਦ ਨਹੀਂ ਸਕਦੇ ਹਨ ਅਤੇ ਥੋੜ੍ਹੇ ਟਾਇਮ ਲਈ ਹੀ ਰੈਂਟ 'ਤੇ ਲੈ ਸਕਦੇ ਹਨ ਉਹਨਾਂ ਨੂੰ ਨਿਵਾਸ ਕਰਨਾ ਵੀ ਬਹੁਤ ਔਖਾ ਹੁੰਦਾ ਹੈ ਜਿਵੇਂ ਕਿ ਉਹ ਕਈ ਹੋਟਲਾਂ ਵਿੱਚ ਵੀ ਨਿਵਾਸ ਕਰਦੇ ਹਨ ਉੱਥੋਂ ਦਾ ਰੈਂਟ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਉਹ ਚੁਕਾ ਨਹੀਂ ਸਕਦੇ ਹਨ ਉਹ ਫਿਰ ਉਹ ਕਈ ਘਰਾਂ ਨੂੰ ਵੀ ਕਿਰਾਏ 'ਤੇ ਲੈਂਦੇ ਹਨ ਜਿਹਨਾਂ ਦਾ ਰੈਂਟ ਬਹੁਤ ਜ਼ਿਆਦਾ ਹੁੰਦੇ ਹਨ ਕਈ ਲੋਕ ਉਹਨਾਂ ਸੈਲਾਨੀਆਂ ਨੂੰ ਦੇਖ ਕੇ ਲੁੱਟ ਵੀ ਲੈਂਦੇ ਹਨ ਜੋ ਕਿ ਚੰਗੀ ਗੱਲ ਨਹੀਂ ਹੈ ਕਈ ਸੈਲਾਨੀਆਂ ਨੂੰ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ ਹੈ ਜਿਹਨਾਂ ਕਾਰਨ ਉਹਨਾਂ ਦੀ ਸਿਹਤ ਉੱਤੇ ਬਹੁਤ ਅਸਰ ਪੈਂਦਾ ਹੈ ਇੱਥੋਂ ਦਾ ਖਾਣਾ ਪੀਣਾ ਉਹਨਾਂ ਦੇ ਵਾਤਾਵਰਨ ਲਈ ਚੰਗਾ ਨਹੀਂ ਹੁੰਦਾ ਹੈ ਕਿਉਂਕਿ ਉਹ ਦੂਜੇ ਵਾਤਾਵਰਨ ਵਿੱਚ ਆਏ ਹੁੰਦੇ ਹਨ ਅਤੇ ਇੱਥੋਂ ਦਾ ਵਾਤਾਵਰਨ ਅਲੱਗ ਹੋ ਸਕਦਾ ਹੈ ਜਿਸ ਕਾਰਨ ਉਹਨਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਆਵਾਜਾਈ ਲਈ ਵੀ ਬਹੁਤ ਸਾਰੇ ਸਾਧਨਾ ਨੂੰ ਰੈਂਟ ਉੱਤੇ ਲੈਣਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਚੁਣੌਤੀਆਂ ਬਹੁਤ ਹੀ ਮੁਸ਼ਕਿਲ ਭਰੀਆਂ ਅਤੇ ਸੰਕਟ ਭਰੀਆਂ ਹੁੰਦੀਆਂ ਹਨ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਉਹਨਾਂ ਲਈ ਬਹੁਤ ਹੀ ਕਠਿਨ ਹੁੰਦਾ ਹੈ ਉਹ ਜਦ ਵੀ ਕਿਤੇ ਵੀ ਘੁੰਮਣ ਜਾਂਦੇ ਹਨ ਤਾਂ ਇਹ ਚੁਣੌਤੀਆਂ ਹਮੇਸ਼ਾਂ ਉਹਨਾਂ ਦੇ ਸਾਹਮਣੇ ਆ ਕੇ ਖੜ੍ਹੀਆਂ ਹੋ ਜਾਂਦੀਆਂ ਹਨ ਜੋ ਕਿ ਚੰਗੀ ਗੱਲ ਨਹੀਂ ਹੈ ਕਈ ਸੈਲਾਨੀਆਂ ਨੂੰ ਲੋਕ ਲੁੱਟ ਵੀ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਉਸ ਜਗ੍ਹਾ ਦਾ ਭੇਤ ਨਹੀਂ ਹੁੰਦਾ ਹੈ ਜਿਸ ਕਾਰਨ ਲੋਕ ਉਹਨਾਂ ਤੋਂ ਹਰ ਇੱਕ ਚੀਜ਼ ਦੇ ਵੱਧ ਪੈਸੇ ਲੁੱਟ ਲੈਂਦੇ ਹਨ ਇਹ ਗੱਲ ਚੰਗੀ ਨਹੀਂ ਆ ਉਹਨਾਂ ਨੂੰ ਉਸ ਜਗ੍ਹਾ ਦਾ ਭੇਤ ਨਹੀਂ ਹੁੰਦਾ ਹੈ